ਪੰਜ ਅਗਸਤ ਦੋ ਹਜ਼ਾਰ ਪੰਜ ਛੇ ਸਤੰਬਰ ਦੋ ਹਜ਼ਾਰ ਛੇ ਇੱਕ ਫੈਬਰਰੀ ਦੋ ਹਜ਼ਾਰ ਅਠਾਰਾਂ ਬਾਰਾਂ ਜੂਨ ਦੋ ਹਜ਼ਾਰ ਉੱਨੀ ਵੀਹ ਨਵੰਬਰ ਦੋ ਹਜ਼ਾਰ ਵੀਹ